ਵੈਸੇ ਤਾਂ ਬਥੇਰੇ ਸਾਜ਼ ਜੋ ਕਿ ਪੰਜਾਬ ਵਿੱਚ ਪ੍ਰਚੱਲਿਤ ਹਨ ਪਰ ਮੈਂ ਸਭ ਤੋਂ ਜ਼ਿਆਦਾ ਢੋਲ 'ਤੇ ਹੀ ਗਾਉਣਾ ਪਸੰਦ ਕਰਦਾ ਹਾਂ ਢੋਲ ਇੱਕ ਐਸਾ ਲੋਕ ਸਾਜ਼ ਹੈ ਜਿਸ ਉੱਪਰ ਵੱਖ ਵੱਖ ਤਰ੍ਹਾਂ ਦੇ ਨਾਚ ਨੱਚੇ ਜਾ ਸਕਦੇ ਹਨ ਜਿਸ ਜਿਵੇਂ ਭੰਗੜਾ ਧਮਾਲ ਲੁੱਡੀ ਆਦਿ ਢੋਲ ਉੱਪਰ ਬੋਲੀਆਂ ਅਤੇ ਗੀਤ ਗਾਈਆਂ ਜਾ ਸਕਦੇ ਹਨ ਢੋਲ ਇੱਕ ਐਸਾ ਸਾਜ਼ ਹੈ ਜੋ ਹਰ ਇੱਕ ਬੰਦੇ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ ਅਤੇ ਇਸ ਦੀ ਧਮਾਲ ਉੱਪਰ ਹਰੇਕ ਆਪਣਾ ਪੈਰ ਚੱਕਦਾ ਹੈ ਢੋਲ ਉੱਪਰ ਗਾਏ ਗਏ ਗੀਤ ਇਸ ਦੇ ਸਾਜ਼ ਨਾਲ ਨਾਲ ਨਾਲ ਐਸੇ ਹੀ ਲੈਅ ਅਤੇ ਐਸਾ ਸੁਰ ਬਣਾਉਂਦੇ ਹਨ ਜਿਸ ਜੋ ਲੋਕਾਂ ਨੂੰ ਵਧੇਰੇ ਪਸੰਦ ਆਉਂਦਾ ਹੈ